ਸਾਡੇ ਇਲਾਕੇ ਵਿੱਚ ਬਹੁਤ ਸਾਰੇ ਧਾਰਮਿਕ ਤਿਉਹਾਰ ਮਨਾਏ ਜਾਂਦੇ ਜਿਵੇਂ ਦਿਵਾਲੀ ਦੁਸਹਿਰਾ ਹੋਲਾ ਮਹੱਲਾ ਹੋਲੀ ਵਿਸਾਖੀ ਜਿੱਥੋਂ ਤੱਕ ਤਿਉਹਾਰਾਂ ਨੂੰ ਮਨਾਉਣ ਦੀ ਗੱਲ ਹੈ ਸਾਡੇ ਇਲਾਕੇ ਦੇ ਵਿੱਚ ਇਹ ਧਾਰਮਿਕ ਤਿਉਹਾਰ ਵੱਡੇ ਜੋਸ਼ ਔਰ ਉਤਸ਼ਾਹ ਦੇ ਨਾਲ ਮਨਾਏ ਜਾਂਦੇ ਹਨ ਜਿਵੇਂ ਆਪਾਂ ਗੱਲ ਕਰੀਏ ਦਿਵਾਲੀ ਦੀ ਦਿਵਾਲੀ ਤੋਂ ਪਹਿਲਾਂ ਲੋਕ ਆਪਣੇ ਘਰਾਂ ਨੂੰ ਸਵਾਰ ਸੁਬਰਨਾ ਸ਼ੁਰੂ ਕਰ ਦਿੰਦੇ ਹਨ ਘਰਾਂ ਨੂੰ ਲੇਪਾ ਪੋਚੀ ਰੰਗ ਰੋਗਨ ਔਰ ਨਵੇਂ ਨਵੇਂ ਜਿਹੜੇ ਇਕਉਪਮੈਂਟ ਹੈ ਜਿਹੜੇ ਚਾਈਨਾ ਦਾ ਜਿਹੜਾ ਸਮਾਨ ਹੈ ਉਹਨੂੰ ਵਰਤਣਾ ਸ਼ੁਰੂ ਕੀਤਾ ਜਾਂਦਾ ਹੈ ਦਿਵਾਲੀ ਤੋਂ ਪਹਿਲਾਂ ਦਿਵਾਲੀ ਵਾਲੇ ਦਿਨ ਲੋਕ ਲਕਸ਼ਮੀ ਦੀ ਪੂਜਾ ਕਰਦੇ ਹਨ ਉਹਨਾਂ ਦਾ ਇਹ ਖਿਆਲ ਹੈ ਵੀ ਸਾਡੇ ਘਰ ਦੇ ਵਿੱਚ ਲਕਸ਼ਮੀ ਆਉਣੀ ਉਹਨਾਂ ਸਾਡੇ ਘਰ ਦੇ ਵਿੱਚ ਜਿਹੜੀ ਪਰੋਸਪੈਰਿਟੀ ਹੈ ਜਿਹੜੀ ਅਮੀਰੀ ਆ ਪ੍ਰਸਿੱਧੀ ਹੈ ਉਹ ਸਾਡੇ ਘਰ ਦੇ ਵਿੱਚ ਲੈ ਕੇ ਆਉਣੀ ਦੁਸਹਿਰੇ ਨੂੰ ਮਨਾਉਣ ਤੋਂ ਪਹਿਲਾਂ ਕਿਉਂਕਿ ਦਿਵਾਲੀ ਦੁਸਹਿਰੇ ਤੋਂ ਵੀਹ ਦਿਨ ਬਾਅਦ ਮਨਾਈ ਜਾਂਦੀ ਹੈ ਦੁਸਹਿਰੇ ਵੇਲੇ ਰਾਵਣ ਦੇ ਪੁਤਲੇ ਫੂਕੇ ਜਾਂਦੇ ਹਨ ਔਰ ਵੀਹ ਦਿਨ ਜਿਹੜੀ ਰਾਮ ਲੀਲਾ ਹੈ ਸਾਡੇ ਇਲਾਕੇ ਦੇ ਵਿੱਚ ਚੱਲਦੀ ਹੈ ਕਿਉਂ ਤਾਂ ਕਿ ਲੋਕਾਂ ਨੂੰ ਬੁੱਧੂ ਬਣਾਇਆ ਜਾ ਸਕਾ ਜਿਹਨਾਂ ਤਿਉਹਾਰਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ ਸਾਡੇ ਸਮਾਜ ਦੇ ਨਾਲ ਉਹ ਤਿਉਹਾਰ ਸਾਡੇ 'ਤੇ ਥੋਪੇ ਜਾਂਦੇ ਹਨ ਇਸ ਦੇ ਉਲਟ ਹੋਲਾ ਮਹੱਲਾ ਜਿਹੜਾ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਜਿਹੜਾ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਮਨਾਇਆ ਜਾਂਦਾ ਹੈ ਔਰ ਪੰਜਾਬ ਦੇ ਸਾਰੇ ਲੋਕ ਜਿਵੇਂ ਆਪਾਂ ਗੱਲ ਕਰ ਲਈਏ ਆਪਣੇ ਕਪੂਰਥਲੇ ਜ਼ਿਲ੍ਹੇ ਦੀ ਕਪੂਰਥਲੇ ਤੋਂ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਉੱਥੇ ਹੋਲਾ ਮਨਾਉਣ ਉਹ ਜਾਂਦੀ ਹੈ ਹੋਲਾ ਮਨਾਉਣ ਦਾ ਮੇਨ ਮਕਸਦ ਕਿਆ ਹੈ ਗੁਰੂਆਂ ਨੂੰ ਯਾਦ ਕਰਨਾ ਗੁਰੂਆਂ ਨੇ ਤਲਵਾਰ ਫੜਾਈ ਹੱਥ ਦੇ ਵਿੱਚ ਔਰ ਹੋਲੇ ਦਾ ਜਿਹੜਾ ਹੋਲਾ ਹੈ ਹੋਲੀ ਦੇ ਜਿਹੜੇ ਵਿਪਰੀਤ ਹੈ ਇਹ ਗੁਰੂਆਂ ਸਾਹਿਬ ਨੇ ਚਾਲੂ ਕੀਤਾ ਤਾਂ ਕਿ ਜਿਹੜੇ ਸ਼ੂਦਰ ਅਸ਼ੂਤ ਲੋਕ ਹੈ ਜਿਹੜੇ ਗੰਦ ਨਾਲ ਖੇਡਦੇ ਲੋਕ ਸੀਗੇ ਉਹ ਆਪਣੇ ਆਪਣੇ ਜਿਹੜੇ ਵਿਚਾਰ ਆ ਉਹ ਪੇਸ਼ ਕੀਤੇ ਜਾ ਸਕਣ ਅਤੇ ਖੂਨ ਦੀ ਜਿਹੜੀ ਹੋਲੀ ਆ ਉਹ ਖੇਡੀ ਜਾ ਸਕੇ ਸੋ ਗੋਹੇ ਮਿੱਟੀ ਚਿੱਕੜ ਹੋਰ ਲੀਪਾ ਪੋਚੀ ਕਰਨ ਦੀ ਬਜਾਇ ਇਹ ਕੰਮ ਬੜੇ ਵੱਡੇ ਪੱਧਰ ਦੇ ਤੌਰ 'ਤੇ ਉੱਤੇ ਕੀਤਾ ਜਾਂਦਾ ਸੋ ਹੋਲੇ ਨੂੰ ਧਿਆਨ ਵਿੱਚ ਰੱਖਦੇ ਹੋਏ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਹੈ ਸਾਡੇ ਕਪੂਰਥਲੇ ਜ਼ਿਲ੍ਹੇ ਤੋਂ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਜਾਂਦੀ ਹੈ ਧੰਨਵਾਦ